ਸ਼ਹਿਰ ਅਤੇ ਪਿੰਡਾਂ ਦੇ ਸਕੂਲਾਂ 'ਚ ਕਾਫੀ ਕਾਫੀ ਅੰਤਰ ਹੈਗਾ ਜਿਵੇਂ ਕਿ ਸ਼ਹਿਰਾਂ 'ਚ ਜੋ ਟੀਚਰ ਹੈ ਉਹ ਕਾਫੀ ਜ਼ਿਆਦਾ ਸੰਖਿਆ 'ਚ ਹੁੰਦੇ ਆ ਕਿਉਂਕਿ ਮਾਪੇ ਉਹਨਾਂ ਦੇ ਨੇੜੇ ਨੇੜੇ ਹੁੰਦੇ ਆ ਅਤੇ ਪੜ੍ਹੇ ਲਿਖੇ ਜ਼ਿਆਦਾ ਹੁੰਦੇ ਆ ਉਹਨਾਂ ਨੂੰ ਸਾਰੀ ਸਮਝ ਹੁੰਦੀ ਹੈ ਕਿ ਜੇ ਟੀਚਰ ਪੂਰੇ ਹੋਣਗੇ ਤਾਂ ਫਿਰ ਹੀ ਸਾਡੇ ਬੱਚੇ ਪੜ੍ਹ ਪਾਉਣਗੇ ਪਿੰਡਾਂ 'ਚ ਲੋਕ ਥੋੜ੍ਹਾ ਜਿਹਾ ਧਿਆਨ ਘੱਟ ਦਿੰਦੇ ਆ ਅਤੇ ਕੁਛ ਹੋਰ ਵੀ ਫਿਸਿਲਟੀਆਂ ਜ਼ਿਆਦਾ ਹੁੰਦੀਆਂ ਮੰਨ ਲਓ ਪਿੰਡਾਂ 'ਚ ਇੱਕ ਫਿਸਿਲਟੀ ਜ਼ਿਆਦਾ ਹੁੰਦੀ ਹੈ ਕਿ ਇੱਥੇ ਖੇਡਾਂ ਜ਼ਿਆਦਾ ਹੁੰਦੀਆਂ ਕਿਉਂਕਿ ਏਰੀਆ ਜ਼ਿਆਦਾ ਹੁੰਦਾ ਕਵਰਡ ਏਰੀਆ ਜਾਂ ਖੁੱਲ੍ਹਾ ਏਰੀਆ ਕਾਫੀ ਹੁੰਦਾ ਕਿਉਂਕਿ ਉੱਥੇ ਜ਼ਮੀਨ ਇੰਨੀ ਮਹਿੰਗੀ ਨਹੀਂ ਹੁੰਦੀ ਐਜ ਕੰਪ ਜਿਵੇਂ ਕਿ ਆਪਾਂ ਕੰਪੇਅਰ ਕਰਦੇ ਹਾਂ ਤੁਲਨਾ ਕਰਦੇ ਹਾਂ ਸ਼ਹਿਰੀ ਸ਼ਹਿਰੀ ਸਕੂਲਾਂ ਦੀ ਸ਼ਹਿਰਾਂ 'ਚ ਜਗ੍ਹਾ ਘੱਟ ਹੋਣ ਕਰਕੇ ਉੱਥੇ ਬੱਚਿਆਂ ਨੂੰ ਖੇਡਣ ਲਈ ਓਨੀ ਜਗ੍ਹਾ ਨਹੀਂ ਮਿਲ ਪਾਉਂਦੀ ਜਿੰਨੀ ਕਿ ਪੇਂਡੂ ਬੱਚਿਆਂ ਲਈ ਮਿਲ ਪਾਉਂਦੀ ਆ ਹੋਰ ਸਹੂਲਤਾਂ ਜਿਵੇਂ ਕਿ ਪੜ੍ਹਾਈ ਦੇ ਪੱਖੋਂ ਪੜ੍ਹਾਈ ਦੇ ਪੱਖੋਂ ਥੋੜ੍ਹਾ ਜਿਹਾ ਸ਼ਹਿਰਾਂ 'ਚ ਲੋਕ ਵੱਧ ਧਿਆਨ ਦਿੰਦੇ ਆ ਟੀਚਰ ਵੀ ਵੱਧ ਧਿਆਨ ਦਿੰਦੇ ਆ ਕਿ ਕੋਈ ਆ ਨਾ ਜਾਵੇ ਕੋਈ ਅਫਸਰ ਨਾ ਚੈਕਿੰਗ ਕਰ ਲਏ ਉਹ ਨਾ ਕਰ ਲਏ ਉਹਦਾ ਕਰਕੇ ਹਾਜ਼ਰੀ ਵੀ ਪੂਰੀ ਰਹਿੰਦੀ ਹੈ ਉਹ ਫਿਰ ਬੱਚਿਆਂ ਨੂੰ ਵੀ ਓਨਾ ਹੀ ਡਰ ਰਹਿੰਦਾ ਹੈਗਾ ਇਸ ਕਰਕੇ ਸ਼ਹਿਰਾਂ ਦੀ ਥੋੜ੍ਹੀ ਜਿਹੀ ਜ਼ਿਆਦਾ ਮਹੱਤਤਾ ਦਿੰਦੇ ਆ ਮਾਪੇ ਵੀ ਜ਼ਿਆਦਾ ਮਹੱਤਤਾ ਦਿੰਦੇ ਆ ਟੀਚਰ ਵੀ ਦਿੰਦੇ ਆ ਇਹ ਅੰਤਰ ਕਾਫੀ ਹੈਗੇ ਆ ਇਹ 'ਚ